ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਕੀ ਹਾਲ ਚਾਲ ਨੇ ਜੀ ਸਾਹਿਲ ਹੋਟਲ ਤੋਂ ਗੱਲ ਕਰ ਰਹੇ ਹੋ ਅਸੀਂ ਜਲੰਧਰ ਸਾਇਡ ਘੁੰਮਣ ਆਉਣਾ ਸੀ ਜਿਵੇਂ ਕਿ ਨਾ ਸਰਦੀਆਂ ਦੇ ਵਿੱਚ ਦਸੰਬਰ ਵਾਲੀਆਂ ਛੁੱਟੀਆਂ ਹੁੰਦੀਆਂ ਉਹਦੇ ਵਿੱਚ ਬੱਚਿਆਂ ਦੇ ਨਾਲ ਆਉਣਾ ਸੀ ਮੈਂ ਸੁਣਿਆ ਹੈ ਵੀ ਤੁਹਾਡੇ ਹੋਟਲ ਦਾ ਖਾਣਾ ਬੜਾ ਵਧੀਆ ਹੁੰਦਾ ਜਿਵੇਂ ਕਿ ਅਸੀਂ ਬਾਏ ਟਰੇਨ ਆਉਣਾ ਸੀ ਬਾਏ ਟਰੇਨ ਦੇ ਵਿੱਚ ਜਿਵੇਂ ਕਿ ਵੇਲੇ ਕਵੇਲੇ ਮੀਂਹ ਨੇਰੀ ਝੱਖੜ ਆ ਜਾਂਦਾ ਕੀ ਤੁ ਤੁਸੀਂ ਉੱਥੇ ਖਾਣਾ ਪਹੁੰਚਾ ਸਕਦੇ ਹੋ ਦੇਰ ਰਾਤ ਵੇਲੇ ਕਵੇਲੇ ਅਤੇ ਤੁਹਾਡਾ ਮੈਂ ਸੁਣਿਆ ਕੀ ਤੁਹਾਡੇ ਸਾਫ਼ ਸਫਾਈ ਹੋਟਲ ਦੀ ਬਹੁਤ ਵਧੀਆ ਹੈ ਵਧੀਆ ਸਰਵਿਸ ਆ ਜਦੋਂ ਵੀ ਅਸੀਂ ਇੱਧਰ ਆਏ ਤੁਹਾਡੇ ਨਾਲ ਜ਼ਰੂਰ ਕੋਂਨਟੈਕਟ ਕਰਾਂਗੇ ਠੀਕ ਆ ਜੀ ਧੰਨਵਾਦ